ਹੈਲੋ ਹੈਲੋ ਸਰ ਮੈਂ ਅਤੁਲ ਬੋਲ ਰਿਹਾ ਗੁਰਦਾਸਪੁਰ ਤੋਂ ਮੈਂ ਤੁਹਾਡੀ ਔਨਲਾਈਨ ਐਡ ਦੇਖੀ ਸੀ ਗੁਰੂ ਨਾਨਕ ਟਰੈਵਲਸ ਦੀ ਜਿਸ 'ਚ ਕਿ ਤੁਸੀਂ ਦੱਸ ਰਹੇ ਸੀ ਕਿ ਮਤਲਬ ਕਾਫ਼ੀ ਸਸਤੇ ਰੇਟਾਂ 'ਤੇ ਤੁਸੀਂ ਟਰੈਵਲ ਕਰਵਾ ਦਿੰਦੇ ਹੋ ਮੈਂ ਵੀ ਆਪਣੇ ਫੈਮਲੀ ਨਾਲ ਸੋਚਿਆ ਹੈ ਕਿ ਸ਼ਿਮਲਾ ਮਨਾਲੀ ਅਤੇ ਜੰਮੂ ਕਸ਼ਮੀਰ ਘੁੰਮਣ ਜੋ ਕਿ ਮੇਰੀ ਫੈਮਿਲੀ ਵਿੱਚ ਹੈਗੇ ਆ ਮੇਰੀ ਸਿਸਟਰ ਮੇਰੇ ਫਾਦਰ ਮੇਰੇ ਮਦਰ ਨਾਲ ਇੱਕ ਛੋਟਾ ਭਰਾ ਪਰ ਸ਼ਾਇਦ ਮੇਰੇ ਚਾਚੀ ਚਾਚਾ ਵੀ ਨਾਲ ਆਉਣ ਇਸ ਕਰਕੇ ਤੁਸੀਂ ਸਾਨੂੰ ਜੇ ਦੱਸ ਸਕੋ ਕਿ ਚਾਰ ਬ ਚਾਰ ਵਾਲੀ ਕੈਬ ਅਤੇ ਸੱਤ ਜਣਿਆਂ ਵਾਲੇ ਕੈਬ ਦਾ ਕੀ ਪ੍ਰਾਈਸ ਹੁੰਦਾ ਨਾਲ ਉਸ ਤੋਂ ਇਲਾਵਾ ਤੁਸੀਂ ਇਹ ਵੀ ਦਸ ਸਕੋ ਸਾਨੂੰ ਕੀ ਜੇ ਸਾਨੂੰ ਡਰਾਈਵਰ ਵੀ ਲੈਣਾ ਸ ਪਏ ਜਾਂ ਉਸ ਤੋਂ ਇਲਾਵਾ ਕਿ ਸਾਨੂੰ ਜੇ ਕੈਬ ਅਸੀਂ ਖੁਦ ਹੀ ਚਲਾ ਕੇ ਲੈ ਸਕੀਏ ਅਤੇ ਉਹਦੇ ਬਾਰੇ ਕੀ ਰੇਟ ਮਿਲ ਸਕਦਾ ਉਸ ਤੋਂ ਇਲਾਵਾ ਤੁਸੀਂ ਇਹ ਵੀ ਸਾਨੂੰ ਦੱਸ ਸਕਦੇ ਹੋ ਕਿ ਜੇ ਤੁਸੀਂ ਖੁਦ ਆਪਣਾ ਕੋਈ ਟੂਰ ਪ੍ਰੋਵਾਈਡ ਕਰਨਾ ਚਾਹੋ ਅਤੇ ਉਹਦਾ ਕੀ ਪ੍ਰਾਈਜ ਹੋਵੇਗਾ ਸਾਡਾ ਐਡਰੈਸ ਹੈਗਾ ਵਾ ਇਹ ਗੁਰੂ ਨਾਨਕ ਗੁਰਦਾਸਪੁਰ ਨੰਗਲ ਕੋਟਲੀ ਮੁਹੱਲਾ ਉਸਦੇ ਸਾਹਮਣੇ ਜਿਹੜਾ ਹੀਰੋ ਸਾਈਕਲਾਂ ਵਾਲੀ ਦੁਕਾਨ ਹੈ ਉਹਦੇ ਲਾਗੇ ਜੇ ਤੁਸੀਂ ਇੱਥੇ ਹੀ ਆਪਣੀ ਕੈਬ ਲੈ ਸਕੋ ਤਾਂ ਉਹ ਵੀ ਬਹੁਤ ਵਧੀਆ ਇਸ ਕਰਕੇ ਜੋ ਵੀ ਇਹਦੀ ਇਨਕੁਆਇਰੀ ਹੋਵੇਗੀ ਉਹਦੇ ਬਾਰੇ ਸਾਨੂੰ ਫੋਨ ਕਰਕੇ ਜ਼ਰੂਰ ਇਹ ਦੱਸ ਦਿਓ ਥੈਂਕ ਯੂ